ਇਕ ਜਨਵਰੀ ਉੱਨੀ ਸੌ ਛਿਆਨਵੇਂ ਵੀਹ ਅਕਤੂਬਰ ਦੋ ਹਜ਼ਾਰ ਇੱਕ ਅੱਠ ਮਾਰਚ ਉੱਨੀ ਸੌ ਪਚਾਨਵੇਂ ਉੱਨੀ ਅਕਤੂਬਰ ਉੱਨੀ ਸੌ ਸਤਾਨਵੇਂ ਦੋ ਜੂਨ ਦੋ ਹਜ਼ਾਰ ਤੇਈ